ਹੈਲੋ ਹਾਂਜੀ ਸਾਈਕਲ ਸਟੋਰ ਤੋਂ ਬੋਲਦੇ ਪਏ ਭਾਅ ਜੀ ਹਾਂਜੀ ਮੇਰਾ ਬੱਚਾ ਅੱਠ ਸਾਲ ਦਾ ਹੈ ਅਤੇ ਉਹਨਾ ਲਈ ਮੈਂ ਇੱਕ ਸਾਈਕਲ ਖਰੀਦਣਾ ਸੀ ਤਾਂ ਕਿਹੜੀ ਕਿਹੜੀ ਕੰਪਨੀ ਦੇ ਜੇ ਹਾਂਜੀ ਅੱਛਿਆ ਅੱਛਾ ਹਾਂਜੀ ਇਹਨਾ ਦੇ ਰੇਟ ਦੱਸ ਸਕੋਗੇ ਹਾਂਜੀ ਠੀਕ ਹਾਂਜੀ ਹਾਂਜੀ ਠੀਕ ਅੱਛਾ ਅੱਛਾ ਹਾਂ ਆ ਠੀਕ ਆ ਇਹ ਕਿੰਨਾ ਕੁ ਟਾਈਮ ਮਤਲਬ ਕਿ ਫੰਡ ਸਕਦੇ ਹਾਂ ਠੀਕ ਹੈ ਹਾਂਜੀ ਠੀਕ ਹੈ ਫੋਟੋ ਵੀ ਭੇਜ ਦਿਓ ਅਤੇ ਦੇਖ ਵੀ ਲਵਾਂਗੇ ਤੁਹਾਡੇ ਸਟੋਰ 'ਤੇ ਆਣ ਕੇ ਠੀਕ ਹੈ ਓ ਓਕੇ ਸਰ